ਭੰਗੜਾ ਸਾਡੇ ਪੰਜਾਬ ਦਾ ਮੁੱਖ ਨਾਚ ਹੈ ਇਹ ਵਿਆਹ ਸ਼ਾਦੀਆਂ ਤਿਉਹਾਰਾਂ ਫੰਕਸ਼ਨਾਂ ਵਿਸਾਖੀ ਲੋਹੜੀ ਇੱਦਾਂ ਦੇ ਫੰਕਸ਼ਨਾਂ 'ਤੇ ਪਾਇਆ ਜਾਂਦਾ ਹੈ ਇਸ ਨੂੰ ਇਹ ਬਾਹਰ ਕੰਟਰੀਆਂ ਵਿੱਚ ਵੀ ਪਾਇਆ ਜਾਂਦਾ ਹੈ ਇਸਨੂੰ ਬਹੁਤ ਜ਼ਿਆਦਾ ਖੁਸ਼ ਨੇ ਲੋਕ ਮਤਲਬ ਭੰਗੜਾ ਪਾ ਕੇ ਭੰਗੜਾ ਇਹੋ ਜਿਹੀ ਚੀਜ਼ ਹੈ ਕਿ ਜਿਸ ਨੂੰ ਕਰਕੇ ਮਨ ਖੁਸ਼ ਹੁੰਦਾ ਹੈ ਭੰਗੜਾ ਬ ਹਰ ਇੱਕ ਅਲੱਗ ਅਲੱਗ ਰਾਜਾਂ ਵਿੱਚ ਸਟੇਟਾਂ ਵਿੱਚ ਪਾਇਆ ਜਾਂਦਾ ਹੈ ਇਸ ਦਾ ਪਹਿਰਾਵਾ ਕੁੜਤਾ ਚਾਦਰਾ ਨੋਕਾਂ ਵਾਲੀਆਂ ਜੁੱਤੀਆਂ ਪੱਗਾਂ ਇੱਦਾਂ ਦਾ ਹੀ ਇਹਨਾਂ ਕੰਠੀਆਂ ਕੰਠੇ ਇਹਨਾਂ ਦਾ ਪਹਿਰਾਵਾ ਹੈ ਭੰਗੜੇ ਭੰਗੜੇ ਦਾ ਭੰਗੜਾ ਹਰ ਇੱਕ ਫੰਕਸ਼ਨ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਭੰਗੜਾ ਪਾਉਣ ਦਾ ਕੋਈ ਟਾਈਮ ਕੋਈ ਜਗ੍ਹਾ ਇੱਦਾਂ ਕੁਛ ਵੀ ਨਹੀਂ ਹੁੰਦਾ ਹੈਗਾ ਬਸ ਭੰਗੜਾ ਖੁਸ਼ੀ ਦੇ ਮੌਕੇ 'ਤੇ ਹੀ ਪਾਇਆ ਜਾਂਦਾ ਹੈ ਕਿਸੇ ਪ੍ਰੋਗਰਾਮ 'ਤੇ ਕੋਈ ਵਿਆਹ ਸ਼ਾਦੀ ਫੰਕਸ਼ਨ ਲੋਹੜੀ ਇੱਦਾਂ ਦੇ ਹੀ ਪ੍ਰੋਗਰਾਮਾਂ 'ਤੇ ਪਾਇਆ ਜਾਂਦਾ ਹੈ ਭੰਗੜਾ ਸਾਡੇ ਭਾਰਤ ਦਾ ਮੁੱਖ ਨਾਚ ਹੈ ਇਸ ਵਿੱਚ